ਪੰਜਾਬ ਵਿੱਚ ਖਰੀਦਦਾਰੀ ਦੇ ਬਹੁਤ ਸਾਰੇ ਅਨੁਭਵ ਹਨ ਜਿਵੇਂ ਕਿ ਲੁਧਿਆਣੇ ਉਹ ਮੇਲੇ ਲੱਗਦੇ ਹੈਗੇ ਆ ਛਪਾਰ ਦਾ ਮੇਲਾ ਮਸ਼ਹੂਰ ਹੈਗਾ ਉੱਥੇ ਬਹੁਤ ਸਾਰੀਆਂ ਚੀਜ਼ਾਂ ਸਸਤੇ ਰੇਟਾਂ 'ਤੇ ਜਾਂ ਵਾਜਿਬ ਰੇਟਾਂ 'ਤੇ ਮਿਲ ਜਾਂਦੀਆਂ ਸਾਨੂੰ ਅਤੇ ਬਹੁਤ ਸਾਰੀ ਵਰਾਇਟੀ ਮਿਲ ਜਾਂਦੀ ਹੈ ਅਤੇ ਜੋ ਕਿ ਹੋਰ ਕਿਤੇ ਨਹੀਂ ਮਿਲਦੀ ਇਸ ਤਰ੍ਹਾਂ ਹੀ ਲੁਧਿਆਣੇ ਦਾ ਕੱਪੜਾ ਬਹੁਤ ਮਸ਼ਹੂਰ ਹੈਗਾ ਵੱਖ ਵੱਖ ਤਰ੍ਹਾਂ ਦਾ ਜਿਹੜਾ ਕੱਪੜਾ ਹੈਗਾ ਉਹ ਮਿਲਦਾ ਹੈਗਾ ਅਤੇ ਬਹੁਤ ਸਾਰੀਆਂ ਮਿੱਲਾਂ ਹੈਗੀਆਂ ਉਹ ਲੁਧਿਆਣੇ ਹੈਗੀਆਂ ਕੱਪੜੇ ਦੀਆਂ ਮਿੱਲਾਂ ਉਹ ਕੱਪੜਾ ਉੱਥੇ ਹੀ ਤਿਆਰ ਹੁੰਦਾ ਹੈ ਅਤੇ ਉੱਥੇ ਹੀ ਉਹ ਵਿੱਕ ਜਾਂਦਾ ਹੈ ਅਤੇ ਉਸੇ ਤਰ੍ਹਾਂ ਹੀ ਜਿਹੜਾ ਪਟਿਆਲਾ ਸ਼ਹਿਰ ਹੈਗਾ ਉਹਦਾ ਸੂਟ ਬਹੁਤ ਮਸ਼ਹੂਰ ਹੈਗਾ ਪਟਿਆਲਾ ਸ਼ਾਹੀ ਸੂਟ ਬੋਲਦੇ ਉਸਨੂੰ ਅਤੇ ਉਹ ਸਪੈਸ਼ਲੀ ਉੱਥੇ ਹੀ ਸੂਟ ਮਿਲਣੇ ਹੋਰ ਕਿਤੇ ਸੂਟ ਹੀ ਨਹੀਂ ਮਿਲ ਸਕਦੇ ਉਹ ਅਤੇ ਇਸ ਤਰ੍ਹਾਂ ਹੋਰ ਅਸੀਂ ਜੁੱਤੀ ਪਾਉਂਦੇ ਹਾਂ ਮੁਕਤਸਰੀ ਜੁੱਤੀ ਜਾਂ ਕੁੜਤਾ ਪਜਾਮਾ ਉਹ ਉੱਥੋਂ ਦਾ ਹੀ ਮਸ਼ਹੂਰ ਹੈ ਅਤੇ ਇਹ ਸਿਰਫ਼ ਉਹ ਅਤੇ ਮੁਕਤਸਰ ਤੋਂ ਹੀ ਉਹ ਜੁੱਤੀ ਜਾਂ ਉਹ ਕੁੜਤਾ ਪਜਾਮਾ ਮਿਲੇਗਾ ਅਤੇ ਇਸ ਤਰ੍ਹਾਂ ਕਿਸੇ ਨੂੰ ਜੀਪਾਂ ਦਾ ਸ਼ੌਂਕ ਹੋਵੇ ਅਤੇ ਉਸ ਮੋਗੇ ਜ਼ਿਲ੍ਹੇ ਵਿੱਚ ਜੀਪਾਂ ਬਹੁਤ ਸੋਹਣੇ ਤਰ੍ਹਾਂ ਦੀ ਮਿਲਦੀਆਂ ਹਨ ਜਿਸ ਤਰ੍ਹਾਂ ਦਾ ਮਰਜ਼ੀ ਡਿਜ਼ਾਇਨ ਪਾ ਲਉ ਜਿਸ ਤਰ੍ਹਾਂ ਦਾ ਮਰਜ਼ੀ ਇੰਜਣ ਰੱਖ ਲਉ ਉੱਥੇ ਜਾ ਕੇ ਅਤੇ ਇਸ ਤਰ੍ਹਾਂ ਬਹੁਤ ਵਿਲੱਖਣ ਹੈਗੇ ਅਨੁਭਵ ਇਹ ਅਤੇ ਇਹ ਖਾਸ ਜਗ੍ਹਾ 'ਤੇ ਹੀ ਸਾਨੂੰ ਮਿਲ ਸਕਦੇ ਹੈਗੇ